ਹੈਲੋ ਨਮਸਕਾਰ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਗੱਲ ਕਰ ਰਹੇ ਹੋ ਸਰ ਮੈਂ ਚੰਦਨ ਕਾਰਡਾ ਬੋਲ ਰਿਹਾ ਜੀ ਫਾਜ਼ਿਲਕਾ ਤੋਂ ਤੁਹਾਡਾ ਨਾਮ ਜਾਣ ਸਕਦਾ ਮੈਂ ਠੀਕ ਹੈ ਠੀਕ ਹੈ ਸਰ ਐਕਚੁਲੀ ਸਾਡੇ ਨਾ ਹੁਣ ਝੋਨਾ ਅਸੀਂ ਲਾਇਆ ਹੋਇਆ ਅਸੀਂ ਉਹਨੂੰ ਅਸੀਂ ਵੱਢਿਆ ਅਤੇ ਸਾਨੂੰ ਅੱਗੇ ਕਣਕ ਦੀ ਬਿਜਾਈ ਅਤੇ ਸਰੋਂ ਦੀ ਬਿਜਾਈ ਦੀ ਬੀਜਾਂ ਦੀ ਲੋੜ ਹੈ ਅਤੇ ਇਸ ਵਾਰੀ ਕੋਈ ਨਵੀਂ ਕੁਆਲਿਟੀ ਬੀਜਣਾ ਚਾਅ ਰਿਹਾ ਇਹਨਾਂ ਦੇ ਬਾਰੇ ਇਨਫੋਰਮੇਸ਼ਨ ਮਿਲ ਸਕਦੀ ਹੈ ਦੱਸੀਏ ਦੱਸੋ ਸਰ ਪਲੀਜ਼ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਹਾਂਜੀ ਹਾਂਜੀ ਹਾਂਜੀ ਠੀਕ ਹੈ ਜ਼ਮੀਨ ਸਾਡੇ ਕੋਲ ਇੱਕੀ ਕਿੱਲੇ ਹੈਗੀ ਸਰ ਅਸੀਂ ਫਾਜ਼ਿਲਕਾ ਦੇ ਰਹਿਣ ਵਾਲੇ ਹਾਂ ਸਰ

ਅੱਛਾ ਅੱਛਾ ਠੀਕ ਹੈ ਠੀਕ ਹੈ ਸਰ ਠੀਕ ਹੈ ਨਹੀ ਬਸ ਉਹੀ ਰੱਖਿਆ ਹੋਇਆ ਸਰ ਅਸੀਂ ਨਹੀਂ ਅਸੀਂ ਨਾ ਮੇਨ ਤਾਂ ਕਣਕ ਬੀਜਣੀ ਹੈਗੀ ਹੈ ਇਹਨਾਂ ਦਾ ਸਾਨੂੰ ਦੱਸੋ ਕਿਹੜਾ ਬੀਜ ਬੈਸਟ ਹੈਗਾ ਕਿਹਨਾਂ ਦੀ ਆਊਟਪੁੱਟ ਵਧੀਆ ਠੀਕ ਹੈ ਜੀ ਠੀਕ ਹੈ ਹਾਂਜੀ ਥੈਂਕ ਯੂ